ਜਿਸ ਕੱਪੜੇ ਨੂੰ ਬਣਾਉਣਾ ਹੁੰਦਾ ਹੈ ਉਸ ਕੱਪੜੇ ਦੀ ਬਣਤਰ ਦੇ ਹਿਸਾਬ ਨਾਲ ਮੈਂ ਡਿਜ਼ਾਈਨ ਅਤੇ ਪੈਟਰਨ ਚੁਣਦੀ ਹਾਂ ਇਹ ਫੈਸਲਾ ਕਰਨ ਵਿੱਚ ਮੇਰੀ ਮਦਦ ਮੇਰੀ ਸਹੇਲੀ ਕਰਦੀ ਹੈ ਜੋ ਕਿ ਇੱਕ ਡਿਜ਼ਾਈਨਰ ਹੈ ਉਸ ਨੂੰ ਕੱਪੜੇ ਅਤੇ ਡਿਜ਼ਾਈਨਜ਼ ਬਾਰੇ ਬਹੁਤ ਹੀ ਜਾਣਕਾਰੀ ਹੈ ਮੇਰੇ ਵਿਚਾਰਾਂ ਅਤੇ ਰਚਨਾਤਮਕਤਾ ਦਾ ਸ੍ਰੋਤ ਇੰਸਟਾਗ੍ਰਾਮ ਵੀ ਹੈ ਜਿਸ ਉੱਤੇ ਮੈਂ ਬਹੁਤ ਸਾਰੇ ਡਿਜ਼ਾਈਨਰਜ਼ ਨੂੰ ਫੋਲੋ ਕੀਤਾ ਹੋਇਆ ਹੈ ਉਹ ਆਪਣੀਆਂ ਡਿਜ਼ਾਈਨਜ਼ ਅਤੇ ਪੈਟਰਨ ਦੁਆਰਾ ਪੋਸਟ ਕਰਦੇ ਰਹਿੰਦੇ ਹਨ ਜੋ ਫੋਲੋ ਕਰਕੇ ਮੈਂ ਆਪਣੀਆਂ ਡਰੈੱਸਿਜ਼ ਤਿਆਰ ਕਰਦੀ ਹਾਂ ਮੇਰੀ ਮੇਰੇ ਕੋਲ ਪ੍ਰੇਰਨਾ ਲਈ ਮੇਰੇ ਮਨ ਪਸੰਦ ਬਰੈਂਡ ਅਤੇ ਔਨਲਾਈਨ ਸ੍ਰੋਤ ਹਨ ਜੋ ਕਿ ਮੈਨੂੰ ਮੇਰਾ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ ਇਸ ਕੰਮ ਨਾਲ ਮੇਰੀਆਂ ਸਕਿੱਲਜ਼ ਵੱਧਦੀਆਂ ਹਨ